ਵਿਆਹਾਂ ਵਰਗੇ ਵੱਡੇ ਸਮਾਰੋਹਾਂ ਵਿੱਚ ਪਾਣੀ ਦੀ ਕਿੱਲਤ ਇੱਕ ਬਹੁਤ ਹੀ ਵੱਡੀ ਸਮੱਸਿਆ ਬਣ ਗਈ ਹੈ ਪੰਜਾਬ ਦੇ ਵਿੱਚ ਵਿਆਹ ਬਹੁਤ ਹੀ ਵੱਡੇ ਪੱਧਰ ਦੇ ਸਮਾਰੋਹਾਂ ਵਿੱਚ ਕੀਤਾ ਜਾਣ ਲੱਗ ਪਿਆ ਹੈ ਵਿਆਹ ਵਰਗੇ ਵੱਡੇ ਸਮਾਰੋਹਾ ਦੌਰਾਨ ਵੱਡੀ ਮਾਤਰਾ ਵਿੱਚ ਪਾਣੀ ਦਾ ਪ੍ਰਬੰਧ ਕਰਨ ਲਈ ਅੱਜ ਕੱਲ ਵਾਟਰ ਕੂਲਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਕੰਮ ਮਿੱਟੀ ਦੇ ਘੜਿਆਂ ਦੇ ਵਿੱਚ ਵੀ ਕੀਤਾ ਜਾਂਦਾ ਹੈ ਅਤੇ ਪਲਾਸਟਿਕ ਦੀਆਂ ਵੱਡੀਆਂ ਵੱਡੀਆਂ ਬੋਤਲਾਂ ਵਿੱਚ ਵੀ ਪਾਣੀ ਨੂੰ ਇਕੱਠਾ ਕੀਤਾ ਜਾਂਦਾ ਹੈ ਬਹੁਤ ਹੀ ਵੱਡੇ ਪੱਧਰ ਤੇ ਕੀਤੇ ਗਏ ਪ੍ਰੋਗਰਾਮਾਂ ਦੇ ਵਿੱਚ ਪਾਣੀ ਦੇ ਟੈਂਕਰ ਵੀ ਬੁਲਾਏ ਜਾਂਦੇ ਹਨ ਜੋ ਕਿ ਇਸਤੇਮਾਲ ਵਿੱਚ ਲਏ ਜਾਂਦੇ ਹਨ ਅਤੇ ਵਾਟਰ ਕੂਲਰਾਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ ਅੱਜ ਕੱਲ ਵੱਡੇ ਵੱਡੇ ਪੈਲਸਾਂ ਦੇ ਵਿੱਚ ਵਿਆਹ ਦਾ ਪ੍ਰਬੰਧ ਮਿਲਨ ਵਾਟਰ ਦੀਆਂ ਬੋਤਲਾਂ ਦੇ ਨਾਲ ਕੀਤਾ ਜਾਂਦਾ ਹੈ ਅਤੇ ਘਰਾਂ ਦੇ ਵਿੱਚ ਕੀਤੇ ਗਏ ਵਿਆਹ ਦੇ ਸਮਾਗਮਾਂ ਦੇ ਵਿੱਚ ਮਿੱਟੀ ਦੇ ਘਰੇ ਅਤੇ ਪਲਾਸਟਿਕ ਦੇ ਵੱਡੇ ਵੱਡੇ ਟੱਬਾ ਦੇ ਵਿੱਚ ਪਾਣੀ ਨੂੰ ਇਕੱਠਾ ਕੀਤਾ ਜਾਂਦਾ ਹੈ ਜੋ ਕਿ ਅੱਜ ਦੀ ਸਮੇਂ ਵਿੱਚ ਪੰਜਾਬ ਦੇ ਵਿੱਚ ਪਾਣੀ ਦੀ ਬਹੁਤ ਹੀ ਕਿੱਲਤ ਹੈ ਇਸ ਲੀਏ ਵਿਆਹ ਵਰਗੇ ਵੱਡੇ ਸਮਾਰੋਹਾਂ ਦੇ ਵਿੱਚ ਇਸ ਨੂੰ ਸੰਭਾਲ ਕੇ ਰੱਖਣ ਦੇ ਲਈ ਮਿੱਟੀ ਦੇ ਘੜੇ ਵਾਟਰ ਕੂਲਰ ਵੱਡੀਆਂ ਬੋਤਲਾਂ ਅਤੇ ਪਲਾਸਟਿਕ ਦੇ ਵੱਡੇ ਟੱਪਾ ਦਾ ਬਹੁਤ ਹੀ ਮਹੱਤਵਪੂਰਨ ਉਪਯੋਗ ਕੀਤਾ ਜਾਂਦਾ ਹੈ